ਸਤਿ ਸ਼੍ਰੀ ਅਕਾਲ ਮੈਂ ਕਾਰਤਿਕ ਪਠਾਨਕੋਟ ਤੋਂ ਬੋਲ ਰਿਹਾ ਮੈਂ ਤੁਹਾਨੂੰ ਕਾਨਫਰੰਸਿੰਗ ਸਿਸਟਮ ਬਾਰੇ ਦੱਸਣਾ ਚਾਹੁੰਦਾ ਹਾਂ ਜੋ ਕਿ ਸਾਡੇ ਜੀਵਨ ਲਈ ਕਾਫੀ ਮਹੱਤਵ ਰੱਖਦਾ ਸ ਰੱਖਦਾ ਹੈ ਔਰ ਕਾਫੀ ਹੀ ਫਾਇਦੇਮੰਦ ਸਾਨੂੰ ਕਰੋਨਾ ਦੌਰਾਨ ਫਾਇਦਾ ਫਾਇਦਾ ਕਾਫੀ ਫਾਇਦਾ ਹੋਇਆ ਇਸ ਨਾਲ ਜੋ ਕਿ ਸਾਡੇ ਕਰੋਨਾ ਟਾਈਮ 'ਤੇ ਤੁਹਾਨੂੰ ਜਿਵੇਂ ਪਤਾ ਹੀ ਹੋਵੇਗਾ ਕਿ ਕਰੋਨਾ ਟਾਈਮ 'ਤੇ ਸਾਡੇ ਸਕੂਲ ਬੰਦ ਕੀਤੇ ਗਏ ਸਨ ਕਿ ਕਰੋਨਾ ਕਾਫੀ ਜ਼ਿਆਦਾ ਵੱਧ ਗਿਆ ਸੀ ਔਰ ਸਾਡੇ ਬੱਚਿਆਂ ਲਈ ਕਾਫੀ ਹਾਨੀ ਦਾ ਹਾਨੀਕਾਰਕ ਸੀ ਜਿਸ ਕਰਕੇ ਸਰਕਾਰ ਨੇ ਇੱਕ ਐਪ ਐਪ ਦੀ ਇ ਐਪ ਲੌਂਚ ਕੀਤਾ ਸੀ ਜਿਸ ਦਾ ਨਾਮ ਸੀ ਜੂਮ ਐਪ ਅਤੇ ਉਸ ਉਸ ਸਾਰੇ ਹੀ ਵਿਦਿਆਰਥੀ ਉਸ ਐਪ ਤੋਂ ਆਪਣੀ ਸਟੱਡੀ ਕੰਪਲੀਟ ਕਰਦੇ ਸਨ ਜੋ ਕਿ ਆਪਣੇ ਆਪਣੇ ਟੀਚਰ ਨਾਲ ਕੋਨਫ੍ਰੈਂਸ ਆਪਣੇ ਸਟੂਡੈਂਟ ਆਪਣੇ ਪਾਰਟਨਰ ਆਪਣੇ ਕਲਾਸਮੇਟਸ ਸਾਰੇ ਉਸ ਉਹਨਾਂ ਦੇ ਨਾਲ ਆਪਣੇ ਉਸ ਐਪ ਤੋਂ ਆਪਣੀ ਸਟੱਡੀ ਕੰਪਲੀਟ ਕੀਤੀ ਗਈ ਸੀ ਬਟ ਉਸ ਦੇ ਕੁਝ ਨੁਕਸਾਨ ਵੀ ਸੀ ਜੀਓ ਜਿਵੇਂ ਕਿ ਇ ਨੈਟਵਰਕ ਇਸ਼ੂ ਹੋ ਜਾਣਾ ਆਵਾਜ਼ ਨਹੀਂ ਆਉਣਾ ਪਰ ਉਹਦੇ ਫਾਇਦੇ ਵੀ ਕਾਫੀ ਸਨ ਕਿ ਸਾਨੂੰ ਕਰੋਨਾ ਦੌਰਾਨ ਸਾਡੀ ਪੜ੍ਹਾਈ ਵਿੱਚ ਕਾਫੀ ਸਹੂਲਤਾਂ ਹੋਈ ਸੀ ਉਸ ਦੀ ਔਰ ਸਾਨੂੰ ਕਾਫੀ ਮਦਦ ਕੀਤੀ ਉਸ ਐਪ ਨਾਲ ਔਰ ਅਸੀਂ ਅੱ ਅੱਜ ਇਸ ਇਸ ਮੁਕਾਮ 'ਤੇ ਪਹੁੰਚ ਕੇ ਪਹੁੰਚ ਸਕੇ ਹਾਂ ਅਗਰ ਇਸ ਇਸ ਤਰ੍ਹਾਂ ਨਹੀਂ ਹੁੰਦਾ ਤਾਂ ਅਸੀਂ ਕਰੋਨਾ ਟਾਈਮ ਵਿੱਚ ਪੜ੍ਹਾਈ ਹੀ ਨਹੀਂ ਕਰ ਪਾਉਣੀ ਸੀ ਔਰ ਸਾਡਾ ਸਾਲ ਵੀ ਖ਼ਰਾਬ ਹੋ ਜਾਣਾ ਸੀ ਧੰਨਵਾਦ